ਵਧੀਆ ਵਿਸ਼ਾਲ ਤੂੰ ਬੋਲ ਕੁਛ ਨਹੀਂ ਯਾਰ ਮੈਂ ਤੈਨੂ ਸਮਝ ਨਹੀਂ ਆਉਂਦਾ ਤੂੰ ਇਦਾਂ ਕਰ ਰੋਜਗਾਰ ਦਫਤਰ ਹੈਗਾ ਹਨਾ ਰੋਜਗਾਰ ਦਫ਼ਤਰ ਉੱਥੇ ਜਾ ਕੇ ਉੱਥੇ ਜਾ ਕੇ ਅਪਲਾਈ ਕਰ ਮਾਰਕ ਵੀ ਰੱਬ ਦਾ ਤੂੰ ਨਾ ਅੰਡਿਆਂ ਦੀ ਰੇਹੜੀ ਲਾਉਂਦਾ ਸੀ ਤੂੰ ਆਂਡੀਆ ਦੀ ਰੇਹੜੀ ਨੀ ਲਾਉਂਦਾ ਸੀ ਤੂੰ ਹੈਗੀ ਅੰਡੇ ਕਿਦਾ ਖਰਾਬ ਹੋ ਗਏ ਅੰਡੇ ਕਿਦਾ ਖਰਾਬ ਹੋ ਗਏ ਅੱਛਾ ਅੱਛਾ ਤੇਰਾ ਘਾਟਾ ਹੋ ਗਿਆ ਮੈ ਵੀਂ ਯਾਰ ਛੋਲਿਆਂ ਦੀ ਰੇਹੜੀ ਲਾਉਂਦਾ ਸੀ ਛੋਲੇ ਭਟੁਰੇ ਦੀ

ਮੇਰਾ ਫਰੈਂਡ ਸੀਗਾ ਉਹ ਲਾਂਦਾ ਸੀ ਫੇਰ ਮੈਂ ਉਹਦੇ ਨਾਲ ਹੀ ਹੁੰਦਾ ਪਰ ਹੁਣ ਮੈਂ ਹੈਗਾ ਉਹਦੀ ਇਨਕਮ ਵਧੀਆ ਵੈਸੇ ਹਾਂ ਕਮਾ ਲੈਂਦਾ ਮਹੀਨੇ ਦਾ ਚਾਲੀ ਪੰਜਾਹ ਹਜ਼ਾਰ ਕਿੰਨੇ ਅੱਛਾ ਅੱਛਾ ਅੱਛਾ ਅੱਛਾ ਕਿਉਂ ਵਧੀਆ ਨੀ ਬੰਦੇ ਬੰਦੇ ਵੀ ਸਾਡੇ ਇਦਾਂ ਦੇ ਹੈ ਨਾ ਚੱਜ ਦਾ ਤਾਂ ਹੈ ਨਹੀਂ ਕੋਈ ਵੀ ਚਲ ਕੋਈ ਨੀ ਚਲ ਕੋਈ ਨੀ ਮੈਂ ਬੰਦੇ ਦਾ ਨੀ ਕੋਈ ਨੀ ਵਧੀਆ ਯਾਰ ਇਥੇ ਲੋਕਾਂ ਦੀ ਸੋਚ ਹੀ ਬੜੀ ਲੋਕਾਂ ਦੀ ਸੋਚ ਬੜੀ ਛੋਟੀ ਜਿਹੀ ਹੈ ਹਾਂ ਪਹਿਲਾਂ ਵੀ ਇਨੇ ਹਾਂ ਉਥੇ ਵੀ ਮੈਂ ਪਤਾ ਕਰਕੇ ਆਇਆ ਸੀ ਉਥੇ ਯਾਰ ਹੈ ਨੀ ਸਹੀ ਕੰਮ ਉਹ ਇੱਕ ਵਾਰ ਬੰਦਾ ਜਾਂਦਾ ਸਾਰੀ ਰਾਤ ਰਹਿਣਾ ਪੈਂਦਾ ਰਿਕਵਰੀ ਜਦ ਤੱਕ ਖਤਮ ਨਹੀਂ ਹੁੰਦੀ

ਚਲ ਠੀਕ ਹੈ ਕਿੱਥੇ ਮਿਲਣਾ ਦੱਸ ਦੇ ਹੁਣ ਹੀ ਮਿਲ ਲੇ ਅੱਛਾ ਫੇਰ ਕਿੱਦਾਂ ਤੂੰ ਇਦਾਂ ਕਰ ਗਰਾਂਊਂਡ ਫਲੋਰ ਮੈਂ ਵੀ ਗਰਾਂਊਂਡ ਫਲੋਰ ਤੇ ਆ ਜਾਂਦਾ ਚਲ ਠੀਕ ਆ ਓਕੇ ਆਜਾ ਮਿਲ ਆਜਾ ਮਿਲਣਾ ਤੇ ਆਜਾ